ਸਾਡੇ ਦੇਸ਼ ਦੇ ਵਿੱਚ ਅਧਿਆ ਅਧਿਆਤਮਿਕ ਜਿਹੜੇ ਮਾਰਗ ਦਰਸ਼ਨ ਨੇ ਉਹਨਾਂ ਦੇ ਕਾਫੀ ਸੰਸਥਾਵਾਂ ਨੇ ਹਰ ਧਰਮਾਂ ਦੇ ਵਿੱਚ ਸੰਸਥਾਵਾਂ ਨੇ ਮਤਲਬ ਤਕਰੀਬਨ ਉਹਨਾਂ ਦਾ ਪਬਲਿਕ ਨੂੰ ਸੰਗਤ ਨੂੰ ਬਹੁਤ ਲਾਭ ਮਿਲਦਾ ਉਹ ਧਰਮਾਂ ਦੇ ਨਾਲ ਜੋੜਦੇ ਹੈ ਅਤੇ ਪੂਰੀ ਤਰ੍ਹਾਂ ਸਾਰੇ ਅਗਾਂਹ ਰੱਬੀ ਗਿਆਨ ਵੀ ਦਿੰਦੇ ਨੇ ਜਿਵੇਂ ਕਿ ਵੱਖ ਵੱਖ ਧਰਮ ਨੇ ਸੰਸਥਾਵਾਂ ਨੇ ਉਹਦੇ ਵਿੱਚ ਰੱਬ ਦੇ ਨਾਲ ਜੁੜਨ ਦਾ ਇਹ ਸਾਧਨ ਪਬਲਿਕ ਨੂੰ ਦੱਸਦੇ ਹੈ ਵੀ ਕਿਵੇਂ ਭਗਤੀ ਕਰਨੀ ਹੈ ਭਗਤੀ ਸੰਗੀਤ ਉੱਥੇ ਹਰ ਤਰ੍ਹਾਂ ਦੀ ਸਿੱਖਿਆ ਅਤੇ ਹੋਰ ਢੰਗ ਤਰੀਕੇ ਅਪਣਾਏ ਜਾਂਦੇ ਆ ਜਿਸ ਤੋਂ ਇਹ ਸਿੱਧ ਹੁੰਦਾ ਵੀ ਕੁਦਰਤ ਨੇ ਜੋ ਨਿਯਮ ਬਣਾਏ ਨੇ ਤਕਰੀਬਨ ਉਹਦੇ ਵਿੱਚ ਲੋਕ ਆਪਣਾ ਜੀਵਨ ਸਫਲ ਕਰ ਸਕਦੇ ਹੈ ਓਕੇ